ਹਰ ਸਾਲ ਇੱਕੀ ਜੂਨ ਨੂੰ ਅੰਤਰਾਸ਼ਟਰੀ ਯੋਗਾ ਵਿਸ਼ਵ ਦਿਵਸ ਹਰ ਦੁਨੀਆਂ ਭਰ ਵਿੱਚ ਇੱਕੋ ਸਮੇਂ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਵ ਉਦੇਸ਼ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਤੰਦਰੁਸਤ ਰਹਿਣ ਲਈ ਯੋਗਾ ਪ੍ਰਤੀ ਜਾਗਰੂਕ ਕਰਨਾ ਹੈ ਯੋਗਾ ਦੀ ਕਈ ਵੱਖਰੀ ਸ਼ੈਲੀਆਂ ਹੁੰਦੀਆਂ ਹਨ ਜਿਵੇਂ ਕਿ ਗਰਮ ਯੋਗਾ ਏਰੀਅਲ ਯੋਗਾ ਅਤੇ ਹੋਰ ਮੈਨੂੰ ਖੁਦ ਨੂੰ ਯੋਗਾ ਕਰਨ ਦੇ ਵਿੱਚ ਬਹੁਤ ਦਿਲਚਸਪੀ ਹੈ ਕਿਉਂਕਿ ਇਹ ਸਾਡੇ ਮਨ ਅਤੇ ਤਨ ਨੂੰ ਤੰਦਰੁਸਤ ਰੱਖਦਾ ਹੈ ਅਤੇ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਤਾਂ ਤੋਂ ਵੀ ਬਚਾਉਂਦਾ ਹੈ ਜਦ ਹੁਣ ਗੱਲ ਕਰੀਏ ਅਲੱਗ ਅਲੱਗ ਪ੍ਰਕਾਰ ਦੇ ਯੋਗਾ ਦੀ ਸ਼ੈਲੀ ਕਰਨ ਦੀ ਤਾਂ ਮੈਂ ਇਹਨਾਂ ਦੀ ਕਲਾਸਾਂ ਹੀ ਲਗਾਈਆਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਰੀਅਲ ਯੋਗਾ ਦੀ ਤਾਂ ਇਹ ਇੱਕ ਵਿਸ਼ੇਸ਼ ਫੈਬਰਿਕ ਦੀ ਵਰਤੋਂ ਕਰਦੇ ਹੋਏ ਇੱਕ ਪੂਰੇ ਸਰੀਰ ਦੀ ਲਹਿਰ ਜਿਸ ਨੂੰ ਹੈਮੌਕ ਕਿਹਾ ਜਾਂਦਾ ਹੈ ਇਹ ਹਵਾ ਵਿੱਚ ਲਟਕਦੇ ਹੋਏ ਯੋਗਾਂ ਦੇ ਲੁਭਾਣ ਦਾ ਅਨੁਭਵ ਕਰਨ ਦਾ ਇੱਕ ਵਿਲੱਖਣ ਅਤੇ ਮਨਮੋਹਕ ਤਰੀਕਾ ਪੇਸ਼ ਕਰਦਾ ਹੈ ਇਸ ਨੂੰ ਕਰਨ ਦੇ ਕਈ ਫਾਇਦੇ ਹਨ ਜਿਵੇਂ ਕੀ ਤਣਾਅ ਅਤੇ ਚਿੰਤਾ ਨੂੰ ਘਟਾਉਣਾ ਤਾਕਤਵਰ ਅਤੇ ਲਚਕਦਾਰ ਮਾਸਪੇਸ਼ੀਆਂ ਅਤੇ ਹੋਰ ਇਸ ਨੂੰ ਕਰਨ ਦੀ ਕਈ ਤਕਨੀਕਾਂ ਹੁੰਦੀਆਂ ਹਨ ਜਿਵੇਂ ਕਿ ਉਲਟਾ ਮੁਅੱਤਲ ਅਤੇ ਹੋਰ